ਖਾਣਾ ਪਕਾਉਣ ਦੇ ਲਈ ਕੂਕਿੰਗ ਕਲਾਸਿਜ਼ ਲਿੱਤੀਆਂ ਜਾਂਦੀਆਂ ਹਨ ਜਿਸ ਵਿੱਚ ਹਰ ਤਰ੍ਹਾਂ ਦੇ ਪਕਵਾਨ ਬਣਾਉਣ ਬਾਰੇ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ ਇਹ ਸਿਖਲਾਈ ਸ਼ੋਸ਼ਲ ਮੀਡੀਆ ਰਾਹੀਂ ਜਾਂ ਕੂਕਿੰਗ ਸਿਖਾਉਣ ਵਾਲ਼ੀਆਂ ਸੰਸਥਾਵਾਂ ਰਾਹੀਂ ਵੀ ਦਿੱਤੀ ਜਾਂਦੀ ਹੈ ਇੱਥੇ ਹਰ ਵਰਗ ਦੇ ਲੋਕ ਕੂਕਿੰਗ ਸਿੱਖ ਸਕਦੇ ਹਨ ਇਨ੍ਹਾਂ ਅਦਾਰਿਆਂ ਵਿੱਚ ਜ਼ਿਆਦਾ ਫੀਸ ਵੀ ਨਹੀਂ ਹੁੰਦੀ ਅਤੇ ਸਿਖਲਾਈ ਵੀ ਵਧੀਆ ਦਿੱਤੀ ਜਾਂਦੀ ਹੈ ਤਾਂ ਜੋ ਚੰਗਾ ਭੋਜਨ ਬਣਾਉਣਾ ਸਿੱਖ ਸਕੀਏ